ਦੇਖੋ ਮਾਰਸ਼ਲ ਆਰਟਸ ਦੇ ਵਿੱਚ ਜੇ ਮੈਂ ਕੋਈ ਸਲਾਹਕਾਰ ਜਾਂ ਰੋਲ ਮਾਡਲ ਦੀ ਗੱਲ ਕਰਾਂ ਤਾਂ ਇੱਦਾਂ ਦਾ ਤਾਂ ਮੈਨੂੰ ਹਾਲੇ ਤੱਕ ਮੇਰੀ ਜਾਣਕਾਰੀ ਦੇ ਵਿੱਚ ਕੁਛ ਇੱਦਾਂ ਦਾ ਮਤਲਬ ਮੈਂ ਨਹੀਂ ਦੇਖਿਆ ਹੈਗਾ ਪਰ ਮੈਂ ਦੇਖੋ ਬਚਪਨ ਤੋਂ ਹੀ ਮੇਰੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਨੂੰ ਦੇਖਦੀ ਹਾਂ ਉਹ ਆਰਮੀ ਦੇ ਵਿੱਚ ਸੀਗੇ ਉਹ ਮਤਲਬ ਇਕੱਤੀ ਸਾਲਾਂ ਦੀ ਸਰਵਿਸ ਤੋਂ ਬਾਅਦ ਹੁਣ ਰਿਟਾਇਰ ਹੋਏ ਨੇ ਤਾਂ ਉਹਨਾਂ ਨੇ ਮਤਲਬ ਸ਼ੁਰੂ ਤੋਂ ਮਤਲਬ ਸਾਨੂੰ ਇਹ ਚੀਜ਼ਾਂ ਫਿਜ਼ੀਕਲ ਫਿੱਟ ਰਹਿਣਾ ਮਤਲਬ ਇੱਦਾਂ ਹੈ ਨਾ ਆਹਾ ਮਾਰਸ਼ਲ ਆਰਟਸ ਮਤਲਬ ਇਹਦੇ ਬਾਰੇ ਥੋੜ੍ਹਾ ਥੋੜ੍ਹਾ ਅਸੀਂ ਦੇਖੋ ਸੁਣਦੇ ਰਹੇ ਹਾਂ ਤਾਂ ਮੈਂ ਮਤਲਬ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਇਸ ਚੀਜ਼ ਤੋਂ ਤਾਂ ਮੈਂ ਜੇ ਆਪਣੇ ਵਿ ਵਿਚਾਰ ਸਾਂਝੇ ਕਰਾਂ ਤਾਂ ਮੈਂ ਇਹ ਚੀਜ਼ ਜ਼ਰੂਰ ਕਹਿਣਾ ਚਾਹਾਂਗੀ ਜਿੱਦਾਂ ਹੁਣ ਅੱਜ ਕੱਲ੍ਹ ਆਪਾਂ ਦੇਖੀਏ ਅੱਜ ਕੱਲ੍ਹ ਚੋਰੀਆਂ ਬੜੀਆਂ ਹੋਣ ਲੱਗ ਗਈਆਂ ਆਹਾ ਆਪਾਂ ਸਨੈਚਿੰਗ ਦੀ ਗੱਲ ਕਰੀਏ ਹੈ ਨਾ ਵੀ ਆਪਾਂ ਇਹ ਆਏ ਦਿਨੀਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਵੀ ਕਿਸੇ ਦੀ ਮਤਲਬ ਚੇਨੀ ਖੋਹ ਲਈ ਗਈ ਕਿਸੇ ਦਾ ਫੋਨ ਖਿੱਚ ਲਿਆ ਗਿਆ ਹੈ ਨਾ ਤਾਂ ਇਹੋ ਜਿਹੀਆਂ ਚੀਜ਼ਾਂ ਦੇ ਚਲਦੇ ਮੈਨੂੰ ਲੱਗਦਾ ਜੇ ਇੱਕ ਬੰਦਾ ਕੀ ਹੈ ਇੱਕ ਜੇ ਮਤਲਬ ਇਹਦੇ ਵਿੱਚ ਐਕਸਪਰਟ ਹੋਊਗਾ ਨਿਪੁੰਨ ਨਿਪੁੰਨਤਾ ਜੇ ਹਾਸਿਲ ਕਰਦਾ ਚਾਹੇ ਉਹ ਕੁੜੀ ਹੈ ਚਾਹੇ ਮੁੰਡਾ ਦੋਨਾਂ ਲਈ ਮਤਲਬ ਮੈਂ ਸੇਮ ਚੀਜ਼ ਹੀ ਕਹੂੰਗੀ ਜੇ ਤੁਹਾਨੂੰ ਕਿਤੇ ਨਾ ਕਿਤੇ ਇਹਦੀ ਥੋੜ੍ਹੀ ਜਿਹੀ ਵੀ ਸਮਝ ਹੈਗੀ ਆ ਤਾਂ ਕਿਤੇ ਨਾ ਕਿਤੇ ਤੁਸੀਂ ਇਹ ਚੀਜ਼ਾਂ ਤੋਂ ਬਚ ਸਕਦੇ ਹੋ ਤਾਂ ਕਰਕੇ ਦੇਖੋ ਹਰ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਮਤਲਬ ਹਰ ਕਿਸੇ ਨੂੰ ਇਹ ਚੀਜ਼ ਆਉਣੀ ਚਾਹੀਦੀ ਹੈ ਅਤੇ ਮੈਨੂੰ ਲੱਗਦਾ ਵੀ ਸਕੂਲਾਂ ਦੇ ਵਿੱਚ ਵੀ ਇਹ ਚੀਜ਼ ਨੂੰ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਆਪਾਂ ਬੱਚਿਆਂ ਨੂੰ ਥੋੜ੍ਹਾ ਜਿਹਾ ਇਹਨਾਂ ਬਾਰੇ ਜਾਗਰੂਕ ਕਰ ਸਕੀਏ